ਸਮਾਜ 'ਚ ਬਹੁਤ ਗੱਲਾਂ ਹਨ ਜਿਸ ਬਾਰੇ ਬੰਦਾ ਲਿਖਣਾ ਚਾਹੁੰਦਾ ਹੈ ਪਰ ਮੈਂ ਜੋ ਮੈਨੂੰ ਮੇਨ ਚੀਜ਼ ਲਿਖਣ ਦਾ ਜੇ ਮੌਕਾ ਮਿਲੇ ਉਹ ਮੈਂ ਲਿਖਣਾ ਚਾਹਵਾਂਗੀ ਜਿਵੇਂ ਵਹਿਮਾਂ ਭਰਮਾਂ 'ਤੇ ਮੈਂ ਇੱਕ ਸਿੱਖ ਧਰਮ ਨੂੰ ਵੈਸੇ ਬਿਲੋਂਗ ਕਰਦੀ ਹਾਂ ਮੈਂ ਬਹੁਤ ਪਰੇ ਉੱਠ ਕੇ ਇੱਕ ਵਹਿਮਾਂ ਤੋਂ ਇੱਕ ਜ਼ਿੰਦਗੀ ਬਿਤਾ ਰਹੀ ਹਾਂ ਵਹਿਮ ਦਾ ਜਿਵੇਂ ਕਹਿ ਲਉ ਇੱਕ ਕਹਾਵਤ ਹੈ ਵਹਿਮ ਦਾ ਕੋਈ ਇਲਾਜ ਨਹੀਂ ਇੱਥੇ ਵੀ ਆਂਢ ਗਵਾਂਢ ਵਿੱਚ ਸਾਨੂੰ ਜਿਵੇਂ ਕਰਦੇ ਨੇ ਲੋਕ ਕਿ ਫਲਾਣੇ ਦਿਨ ਨਹੀਂ ਚੰਗਾ ਹੁੰਦਾ ਉਸ ਦਿਨ ਆਹ ਨਾ ਕਰੋ ਇਸ ਦਿਨ ਕੱਪੜੇ ਨਾ ਧੋਵੋ ਉਸ ਦਿਨ ਸਿਰ ਨਾ ਨਾਵੋ ਮੈਂ ਇਹ ਚੀਜ਼ 'ਚ ਸੁਧਾਰ ਲਿਆਉਣਾ ਚਾਹੁੰਦੀ ਹਾਂ ਕਿ ਸਭ ਦਿਨ ਪਰਮਾਤਮਾ ਦੇ ਹੀ ਹੁੰਦੇ ਹਨ ਜਿਵੇਂ ਜਿੰਨਾਂ ਬੰਦਾ ਇਸ ਚੀਜ਼ ਬਾਰੇ ਸੋਚਦਾ ਰਹਿੰਦਾ ਉਨੇ ਹੀ ਵਹਿਮਾਂ ਵਿੱਚ ਚਲਾ ਜਾਂਦਾ ਹੈ ਮੈਂ ਇਸ 'ਤੇ ਕੁਛ ਲਿਖਣਾ ਚਾਹਵਾਂਗੀ ਕਿ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹ ਤੋਂ ਉੱਪਰ ਉੱਠਣ ਲਈ ਕਿਹਾ ਹੈ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਨੇ ਵੀ ਇੱਕ ਸਾਨੂੰ ਇੱਕ ਇਨਸਾਨ ਨੂੰ ਕਿਹਾ ਸੀ ਕਿ ਉਹ ਸੂਰਜ ਨੂੰ ਜਦੋਂ ਪਾਣੀ ਦੇ ਰਿਹਾ ਸੀ ਕਿ ਇਵੇਂ ਤੇਰਾ ਸੂਰਜ ਤਾਂ ਹਜ਼ਾਰਾਂ ਕਿਲੋਮੀਟਰ ਦੂਰ ਹੈ ਉਸਨੂੰ ਕਿਵੇਂ ਤੇਰੇ ਪਾਣੀ ਦੇਣ ਨਾਲ ਪਾਣੀ ਪਹੁੰਚ ਸਕਦਾ ਹੈ ਉਹ ਚੀਜ਼ ਅੱਜ ਵੀ ਚੱਲ ਰਹੀ ਹੈ ਸਾਡੇ ਗੁਰੂਆਂ ਪੀਰਾਂ ਨੇ ਇਸ ਬਾਰੇ ਸਾਨੂੰ ਸਿੱਖਿਆ ਦਿੱਤੀ ਕਿ ਇਹ ਚੀਜ਼ਾਂ 'ਚ ਪੈ ਕੇ ਬੰਦਾ ਜ਼ਿੰਦਗੀ ਸਫਲ ਨਹੀਂ ਕਰ ਸਕਦਾ ਇਹ ਚੀਜ਼ ਬਾਰੇ ਮੈਂ ਕੁਛ ਲਿਖਣਾ ਚਾਹੁੰਦੀ ਹਾਂ ਕਿ ਸਾਡੇ ਗੁਰੂਆਂ ਨੇ ਸਾਨੂੰ ਇਹ ਤੋਂ ਉੱਪਰ ਉੱਠਣ ਲਈ ਕਿਹਾ ਹੈ ਅਤੇ ਸਾਨੂੰ ਇੱਕ ਚੰਗੀ ਸੇਧ ਦਿੱਤੀ ਹੈ ਕਿ ਸਾਨੂੰ ਜ਼ਿੰਦਗੀ ਵਹਿਮਾਂ ਤੋਂ ਦੂਰ ਬਿਤਾਉਣੀ ਚਾਹੀਦੀ ਹੈ